ਮੈਂ ਆਰਮੀ ਦੇ ਵਿੱਚ ਡਿਊਟੀ ਕਰਦਾ ਹੋਇਆ ਆਪਣੇ ਸਮੂਹ ਦੇ ਨਾਲ ਕਰੋਸ ਕੰਟਰੀ ਕਰਦਾ ਰਿਹਾ ਹਾਂ ਅਤੇ ਉਸ ਸਮੇਂ ਸਾਨੂੰ ਕਲੱਬ ਦੇ ਵਿੱਚ ਸ਼ਾਮਿਲ ਹੋ ਕੇ ਕਈ ਪ੍ਰਕਾਰ ਦੇ ਅਨੁਭਵ ਇਕੱਠੇ ਹੋ ਕੇ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਅਤੇ ਦੌੜਨਾ ਮਨ ਭਾਉਂਦਾ ਖਾਣਾ ਅਤੇ ਪਹਿਨਣਾ ਅਸੀਂ ਉਸ ਜਗ੍ਹਾ 'ਤੇ ਕਰਦੇ ਸੀ